ਮੈਂ ਇੱਕ ਵਾਰ ਗੁਜਰਾਤ ਗਿਆ ਅਤੇ ਮੈਂ ਉੱਥੇ ਜਾ ਕੇ ਦੇਖਿਆ ਕਿ ਉੱਥੇ ਬਹੁਤ ਜ਼ਿਆਦਾ ਲੋਕ ਨੇ ਜੋ ਗੁਜਰਾਤੀ ਭਾਸ਼ਾ ਦੇ ਵਿੱਚ ਗੱਲ ਕਰਦੇ ਆ ਅਤੇ ਜਦੋਂ ਕਦੇ ਮੈਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਗੁਜਰਾਤੀ ਭਾਸ਼ਾ ਦੇ ਵਿੱਚ ਬੋਲਦੇ ਆ ਅਤੇ ਨਾ ਤਾਂ ਉਹਨਾਂ ਨੂੰ ਮੇਰੀ ਸਮਝ ਆਉਂਦੀ ਆ ਅਤੇ ਮੈਂ ਪੰਜਾਬੀ ਬੋਲਦਾ ਅਤੇ ਨਾ ਹੀ ਉਹਨਾਂ ਨੂੰ ਮੇਰੀ ਸਮਝ ਆਉਂਦੀ ਹੈ ਪਰ ਪੰਜਾਬੀ ਭਾਸ਼ਾ ਦੇ ਵਿੱਚ ਕੁਛ ਕੁਛ ਇਹੋ ਜਿਹੇ ਸ਼ਬਦ ਹੁੰਦੇ ਹਨ ਅਤੇ ਗੁਜਰਾਤੀ ਦੇ ਵਿੱਚ ਵੀ ਇਹੋ ਜਿਹੇ ਸ਼ਬਦ ਹੁੰਦੇ ਆ ਜੋ ਆਪਸ ਦੇ ਵਿੱਚ ਮਿਲਦੇ ਹਨ ਜਿਹਦੇ ਕਰਕੇ ਗੱਲ ਨੂੰ ਸਮਝਣਾ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ ਹੈ ਪਰ ਫਿਰ ਵੀ ਚੰਗੀ ਤਰ੍ਹਾਂ ਗੱਲ ਸਮਝ ਨਹੀਂ ਆਉਂਦੀ ਪਰ ਮੈਂ ਦੇਖਿਆ ਉੱਥੇ ਲੋਕ ਗੁਜਰਾਤੀ ਦੇ ਨਾਲ ਨਾਲ ਇੰਗਲਿਸ਼ ਅਤੇ ਹਿੰਦੀ ਵੀ ਬੋਲਦੇ ਹਨ ਜਿਹਦੇ ਕਰਕੇ ਉੱਥੇ ਗੱਲ ਕਰਨਾ ਸੌਖਾ ਹੋ ਜਾਂਦਾ ਹੈ ਅਤੇ ਮੈਂ ਅਕਸਰ ਹੀ ਜਦੋਂ ਗੁਜਰਾਤ ਜਾਂਦਾ ਤਾਂ ਮੈਂ ਹਮੇਸ਼ਾ ਉੱਥੇ ਪਹਿਲਾਂ ਇਹ ਪਤਾ ਕਰਦਾ ਵੀ ਕੌਣ ਹਿੰਦੀ ਬੋਲਦਾ ਜਾਂ ਇੰਗਲਿਸ਼ ਬੋਲਦਾ ਤਾਂ ਕਰਕੇ ਮੈਂ ਤਾਂ ਕਿ ਮੈਂ ਉਹਦੇ ਨਾਲ ਗੱਲ ਕਰ ਸਕਾਂ ਅਤੇ ਆਪਣੀ ਜੋ ਵੀ ਪੁੱਛਣਾ ਹੈ ਉਹ ਪੁੱਛ ਸਕਾਂ ਪਰ ਉੱਥੇ ਬਹੁਤ ਜ਼ਿਆਦਾ ਲੋਕ ਅਜਿਹੇ ਵੀ ਨੇ ਜੋ ਪੰਜਾਬੀ ਅਤੇ ਹਿੰਦੀ ਵੀ ਜਾਣਦੇ ਹਨ ਅਤੇ ਕਈ ਵਾਰ ਮੈਨੂੰ ਪੰਜਾਬੀ ਬੋਲਣ ਵਾਲੇ ਲੋਕ ਵੀ ਮਿਲ ਜਾਂਦੇ ਹਨ ਤਾਂ ਕਰਕੇ ਕਈ ਵਾਰ ਮੈਨੂੰ ਉੱਥੇ ਗੱਲਬਾਤ ਕਰਨਾ ਬਹੁਤ ਜ਼ਿਆਦਾ ਸੌਖਾ ਹੋ ਜਾਂਦਾ ਪਰ ਕਈ ਵਾਰ ਅਜਿਹੇ ਇਲਾਕੇ ਦੇ ਵਿੱਚ ਚਲੇ ਜਾਂਦੇ ਹਾਂ ਜਿੱਥੇ ਲੋਕ ਬਿਲਕੁਲ ਵੀ ਪੰਜਾਬੀ ਹਿੰਦੀ ਨਹੀਂ ਜਾਣਦੇ ਹੁੰਦੇ ਤਾਂ ਉੱਥੇ ਮੈਨੂੰ ਗੱਲ ਕਰਨਾ ਬਹੁਤ ਹੀ ਜ਼ਿਆਦਾ ਔਖਾ ਹੋ ਜਾਂਦਾ ਹੈ ਅਤੇ ਤਾਂ ਕਰਕੇ ਉੱਥੇ ਮੈਨੂੰ ਕਿਸੇ ਵੀ ਚੀਜ਼ ਦਾ ਪਤਾ ਨਹੀਂ ਲੱਗਦਾ ਅਤੇ ਉੱਥੇ ਮੈਂ ਗੂਗਲ ਟਰਾਂਸਲੇਟ ਇਹੋ ਜਿਹਾ ਕੁਛ ਯੂਜ ਕਰ ਲੈਂਦਾ